ਸੈਂਕਲ ਦੇ ਆਪਾਂ ਨੂੰ ਬਹੁਤ ਫਾਇਦੇ ਹਨ ਇਸ ਨਾਲ ਆਪਣਾ ਸ ਸਰੀਰ ਇੱਕ ਤਾਂ ਬਿਮਾਰੀਆਂ ਤੋਂ ਬਚ ਜਾਂਦਾ ਹੈ ਅਤੇ ਇੱਕ ਆਪਾਂ ਨੂੰ ਆ ਬਹੁਤ ਸਸਤਾ ਤਾਂ ਮਿਲ ਜਾਂਦਾ ਛੇਤੀ ਆਪਾਂ ਨੂੰ ਅਤੇ ਨਾਲੇ ਇਹਦੀ ਰਿਪੇਅਰ 'ਤੇ ਖਰਚਾ ਘੱਟ ਆਉਂਦਾ ਜਦੋਂ ਮੈਂ ਡੇਲੀ ਘੱਟ ਤੋਂ ਘੱਟ ਦੱਸ ਜਾਂ ਪੰਦਰਾਂ ਕਿਲੋਮੀਟਰ ਸੈਂਕਲ 'ਤੇ ਵਰ੍ਹਿਸ਼ ਕਰਦਾ ਹਾਂ ਇਸ ਨਾਲ ਮੇਰੇ ਸਰੀਰ 'ਤੇ ਖੂਨ ਦਾ ਦੌਰਾ ਬਦਲ ਜਾਂਦਾ ਜਿਸ ਨਾਲ ਮੇਰਾ ਸਰੀਰ ਹੋਰ ਰਿਸ਼ਟ ਪੁਸ਼ਟ ਹੋ ਜਾਂਦਾ ਤਾਂ ਜੋ ਮੈਂ ਹੋਰ ਅੱਗੇ ਵਧਾ ਹੋਰ ਕੋਈ ਕੰਮ ਕਰਾਂ ਜਾ ਕੇ ਇਸ ਤਰ੍ਹਾਂ ਮੈਂ ਲੋਕ ਹੁਣ ਦੂਰ ਦਰਾਡੇ ਆਲ ਇੰਡੀਆ ਘੁੰਮਣਾ ਚਾਹੁੰਦੇ ਸੈਂਕਲ ਨਾਲ ਤਾਂ ਜੋ ਕਿ ਆਪਾਂ ਨੂੰ ਹਰ ਇੱਕ ਚੀਜ਼ ਦੀ ਜਗ੍ਹਾ ਬਾਰੇ ਨੌਲੇਜ ਹੋ ਸਕੇ ਇਹਨਾਂ ਸੈਂਕਲ ਤਾਂ ਸੈਂਕਲ ਚਲਾਉਣਾ ਨਾਲ ਜਿੱਥੇ ਦਿਲ ਕਰਦਾ ਆਪਾਂ ਖੜ੍ਹ ਜਾਂਦੇ ਹਾਂ ਔਰ ਸਾਹ ਲੈ ਸਕਦੇ ਹਾਂ ਆਪਾਂ ਇਹ ਨਾਲ ਰਾਹ 'ਚ ਜਾਂਦੇ ਅਤੇ ਆਪਾਂ ਕਿਸੇ ਨਾਲ ਵੀ ਜਗ੍ਹਾ ਦੀ ਜਗ੍ਹਾ 'ਤੇ ਰੁਕਣਾ ਰੁਕ ਜੋ ਜਾ ਕੇ ਮੱਥਾ ਟੇਕ ਲਉ ਜੇ ਉਹ ਗੁਰਦੁਆਰਾ ਸਾਹਿਬ ਰੁਕਣਾ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕ ਲਓ ਅਤੇ ਉੱਧਰੋਂ ਫਿਰ ਚੱਲ ਪਓ ਇਹਦੇ ਨਾਲ ਆਪਾਂ ਜੇ ਆਪਾਂ ਇਹਦੇ ਨਾਲ ਲੋਕ ਬਿਮਾਰੀਆਂ ਤੋਂ ਬਚੇ ਰਹਿੰਦੇ ਆ ਅਤੇ ਇੱਕ ਆਪਾਂ ਪਹਿਲਾਂ ਲੋਕ ਸੈਂਕਲ 'ਤੇ ਬਹੁਤ ਤੋਰਾ ਫੇਰਾ ਕਰਦੇ ਹੁੰਦੇ ਸੀ ਤਾਂ ਜੋ ਉਹ ਬਿਮਾਰੀਆਂ ਤੋਂ ਬਚੇ ਰਹਿਣ ਇਸ ਲਈ ਹੁਣ ਉਹਨਾਂ ਨੂੰ ਦੇਖ ਕੇ ਮੈਂ ਵੀ ਇੱਦਾਂ ਸੋਚਦਾ ਕਿ ਆਪਾਂ ਵੀ ਸੈਂਕਲ ਦੀ ਰੋਜ਼ ਵਰਤੋਂ ਕਰੋ ਘੱਟ ਤੋਂ ਦੱਸ ਪੰਦਰਾਂ ਕਿਲੋਮੀਟਰ ਡੇਲੀ ਚੱਲੀਏ ਅਤੇ ਨਾਲੇ ਇਸ ਵਾਰ ਮੇਰਾ ਨੈਣਾ ਦੇਵੀ ਜਾਣ ਦਾ ਪਲੈਨ ਹੈ ਤਾਂ ਜੋ ਮੈਂ ਸਾਰੇ ਗੁਰਦੁਆਰਾ ਸਾਹਿਬ ਅਤੇ ਜਿੰਨੀਆਂ ਵੀ ਧਾਰਮਿਕ ਸੰਥਾਵਾਂ ਹੈ ਜਾਂ ਕੋਈ ਹੋਰ ਜਗ੍ਹਾ ਹੈ ਉੱਥੇ ਜਾ ਕੇ ਸੈਂਕਲ 'ਤੇ ਜਾ ਕੇ ਮੱਥਾ ਟੇਕਾਂ ਤਾਂ ਜੋ ਮੈਨੂੰ ਇੱਕ ਸਰੀਰ ਨੂੰ ਮੇਰੇ ਸੰਤੁਸ਼ਟੀ ਮਿਲੇ ਤਾਂ ਜੋ ਮੈਂ ਇਸ ਬਾਰੇ ਹੋਰ ਅੱਗੇ ਬਾਰੇ ਸੋਚਣ ਵਾਲੇ ਲੋਕਾਂ ਨੂੰ ਕਹਾਂ ਕਿ ਵੀ ਚੀਜ਼ ਬਹੁਤ ਵਧੀਆ